ਅੱਠ ਲੱਖ ਛਿਆਹਠ ਹਜ਼ਾਰ ਛੇ ਸੌ ਛਿਆਹਠ ਛੇ ਲੱਖ ਬਾਰ੍ਹਾਂ ਹਜ਼ਾਰ ਇੱਕ ਸੌ ਬਾਰ੍ਹਾਂ ਪੰਜ ਲੱਖ ਸੱਤਰ ਹਜ਼ਾਰ ਸੱਤ ਸੌ ਸੱਤਰ ਦੋ ਲੱਖ ਬਾਹਠ ਹਜ਼ਾਰ ਇੱਕ ਸੌ ਨੱਬੇ ਇੱਕ ਲੱਖ ਇੱਕ ਹਜ਼ਾਰ ਇੱਕ ਸੌ ਨੜਿਨਵੇਂ